ਨਮਸਕਾਰ ਮੇਰਾ ਨਾਮ ਸਾਕਸ਼ੀ ਹੈ ਅਤੇ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਮੇਰੇ ਮਨਪਸੰਦ ਅਧਿਆਤਮਿਕ ਅਧਿਆਪਕ ਸ਼੍ਰੀ ਅਨੀਰੁਧ ਅਚਾਰਿਆ ਜੀ ਮਹਾਰਾਜ ਹਨ ਅਤੇ ਉਹ ਮੈਨੂੰ ਟੀ ਵੀ ਰਾਹੀਂ ਮਿਲੇ ਉਹਨਾਂ ਦਾ ਪ੍ਰਚਾਰ ਮੈਂ ਫੋਨ ਵਿੱਚ ਵੀ ਵੇਖਿਆ ਅਤੇ ਮੈਂ ਟੀ ਵੀ ਵਿੱਚ ਵੀ ਬਹੁਤ ਸਾਰਾ ਵੇਖਿਆ ਹੈ ਮੇਰੇ ਮਾਤਾ ਜੀ ਸਵਯਮ ਉਹਨਾਂ ਨੂੰ ਉਹਨਾਂ ਦੇ ਆਸ਼ਰਮ ਜਾ ਕੇ ਮਿਲ ਕੇ ਆਏ ਹਨ ਉਹ ਬਹੁਤ ਹੀ ਚੰਗੇ ਹਨ ਉਹ ਸਾਨੂੰ ਬਹੁਤ ਕੁਛ ਸਿਖਾਉਂਦੇ ਹਨ ਧਰਮਾਂ ਬਾਰੇ ਉਹ ਸਾਨੂੰ ਸਾਰਾ ਗਿਆਨ ਪ੍ਰਦਾਨ ਕਰਦੇ ਹਨ ਉਹ ਸਾਨੂੰ ਸਾਡੇ ਜੀਵਨ ਵਿ ਦੇ ਅਸਲ ਲਕਸ਼ ਤੱਕ ਪਹੁੰਚਣ ਬਾਰੇ ਸਿਖਾਉਂਦੇ ਹਨ ਅਤੇ ਉਹ ਸਾਨੂੰ ਹਮੇਸ਼ਾ ਪਰਮਾਤਮਾ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਦੇ ਹਨ ਉਹ ਸਾਨੂੰ ਦੱਸਦੇ ਹਨ ਕਿ ਸਾਡੇ ਜੀਵਨ ਦਾ ਅੰਤਿਮ ਆਸਾਰ ਪਰਮਾਤਮਾ ਦੀ ਭਗਤੀ ਹੀ ਹੈ ਸਾਨੂੰ ਉਹਨਾਂ ਦੀ ਭਗਤੀ ਕਰਨੀ ਚਾਹੀਦੀ ਹੈ ਅਤੇ ਉਹਨਾਂ ਦੇ ਚਰਨਾਂ ਵਿੱਚ ਧਿਆਨ ਲਾਉਣਾ ਚਾਹੀਦਾ ਹੈ ਮੇਰੇ ਮਨਪਸੰਦ ਅਧਿਆਪਕ ਅਨੀਰੁਧ ਅਚਾਰਿਆ ਜੀ ਮਹਾਰਾਜ ਮੈਨੂੰ ਟੀ ਵੀ ਰਾਹੀਂ ਮਿਲੇ ਅਤੇ ਮੈਂ ਉਹਨਾਂ ਦੀ ਰੋਜ਼ ਕਥਾ ਸੁਣਦੀ ਹਾਂ ਅਤੇ ਉਹਨਾਂ 'ਤੇ ਅਮਲ ਕਰਦੀ ਹਾਂ ਧੰਨਵਾਦ